ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਖੇਡਾਂ ਖੇਡਣ ਵਿੱਚ ਕਾਫੀ ਅੰਤਰ ਹੈ ਸਭ ਤੋਂ ਪਹਿਲਾਂ ਅੰਤਰ ਵਾਤਾਵਰਨ ਦਾ ਹੈ ਵਾਤਾਵਰਣ ਤੋਂ ਭਾਵ ਕਿ ਸ਼ਹਿਰ ਦੇ ਪਿੰਡ ਦਾ ਜੋ ਵਾਤਾਵਰਨ ਹੈ ਇੱਕ ਦੂਜੇ ਦੇ ਉਲਟ ਹੈ ਸ਼ਹਿਰ ਦੇ ਬੱਚੇ ਜ਼ਿਆਦਾ ਪੜ੍ਹੇ ਲਿਖੇ ਹੁੰਦੇ ਹਨ ਜਦੋਂ ਕਿ ਇਸ ਦੇ ਮੁਕਾਬਲੇ ਪੇਂਡੂ ਬੱਚਿਆਂ ਨੂੰ ਖੇਡਾਂ ਬਾਰੇ ਜ਼ਿਆਦਾ ਗਿਆਨ ਨਹੀਂ ਹੁੰਦਾ ਪਿੰਡ ਵਿੱਚ ਬੱਚੇ ਖਿਦੋਖੁੰਡੀ ਕੋਟਲਾ ਛਪਾਕੀ ਗੋਲੀਆਂ ਅਤੇ ਗੁੱਲੀ ਡੰਡਾ ਖੇਡਦੇ ਹਨ ਜਦੋਂ ਕਿ ਸ਼ਹਿਰ ਦੇ ਬੱਚੇ ਆਧੁਨਿਕ ਖੇਡਾਂ ਜਿਵੇਂ ਕਿ ਕ੍ਰਿਕਟ ਬੈਡਮਿੰਟਨ ਵੋਲੀਬੋਲ ਵਰਗੀਆਂ ਖੇਡਾਂ ਖੇਡਦੇ ਹਨ ਪਿੰਡ ਵਿੱਚ ਬੱਚੇ ਸ਼ੁੱਧ ਖੁਰਾਕ ਖਾਂਦੇ ਹਨ ਜਿਸ ਕਰਕੇ ਉਹ ਕਬੱਡੀ ਵਰਗੀਆਂ ਖੇਡਾਂ ਖੇਡਦੇ ਹਨ ਇਹਦੇ ਉਲਟ ਸ਼ਹਿਰੀ ਬੱਚਿਆਂ ਨੂੰ ਕਬੱਡੀ ਖੇਡਣਾ ਬੜਾ ਮੁਸ਼ਕਿਲ ਹੁੰਦਾ ਹੈ ਪੇਂਡੂ ਖੇਤਰਾਂ ਵਿੱਚ ਬੱਚੇ ਛੋਟੇ ਹੁੰਦੇ ਹੀ ਮਾਂ ਬਾਪ ਨਾਲ ਤੈਰਾਕੀ ਸਿੱਖ ਜਾਂਦੇ ਹਨ ਜਦੋਂ ਕਿ ਸ਼ਹਿਰੀ ਇਲਾਕੇ ਵਿੱਚ ਇਹ ਚੀਜ਼ਾਂ ਬੱਚਿਆਂ ਨੂੰ ਬੜੀ ਮੁਸ਼ਕਿਲ ਨਾਲ ਸਿਖਾਈਆਂ ਜਾਂਦੀਆਂ ਹਨ ਇਹ ਗੱਲ ਇਸ ਕਰਕੇ ਹੁੰਦੀ ਹੈ ਕਿਉਂਕਿ ਪਿੰਡ ਵਿੱਚ ਟੋਬੇ ਅਤੇ ਛੱਪੜ ਹੁੰਦੇ ਹਨ ਜਦੋਂ ਕਿ ਸ਼ਹਿਰਾਂ ਵਿੱਚ ਸਵੀਵਿੰਗ ਪੂਲ ਹਰ ਥਾਂ 'ਤੇ ਉਪਲਬਧ ਨਹੀਂ ਹੁੰਦੇ